ਲੁਧਿਆਣਾ ਇੱਕ ਬਹੁਤ ਵੱਡਾ ਸ਼ਹਿਰ ਹੈ ਇੱਥੇ ਬਹੁਤ ਬਹੁਤ ਵੱਡੇ ਲੋਕ ਰਹਿੰਦੇ ਹਨ ਇੱਥੇ ਲੋਕਾਂ ਨੇ ਵੱਡੀਆਂ ਵੱਡੀਆਂ ਫੈਕਟਰੀਆਂ ਪਾਈਆਂ ਹੋਣ ਹਾਈਆਂ ਪਾਈਆਂ ਹੋਈਆਂ ਹਨ ਅਤੇ ਬਹੁਤ ਲੋਕਾਂ ਦੇ ਫੈਕਟਰੀਆਂ ਵਿੱਚ ਦੇ ਕੰਮ ਚਲਦੇ ਹਨ ਪੈਕਿੰਗ ਚਲਦੀ ਹੈ ਇੱਥੇ ਜਿਵੇਂ ਕਿ ਲੋਕ ਵੱਡੀਆਂ ਵੱਡੀਆਂ ਫੈਕਟਰੀਆਂ ਪਾ ਕੇ ਉੱਥੇ ਆਪਣੇ ਕੰਮ ਦਾ ਸ਼ੁਰੂਆਤ ਕਰਦੇ ਹਨ ਅਤੇ ਆਪਣਾ ਰੁਜ਼ਗਾਰ ਸ਼ੁਰੂ ਕਰਦੇ ਹਨ ਇਹ ਲੁਧਿਆਣੇ ਇੱਕ ਬਹੁਤ ਲੁਧਿਆਣੇ ਇੱਕ ਬਹੁਤ ਵੱਡੀ ਵੱਡੀਆਂ ਵੱਡੀਆਂ ਫੈਕਟਰੀਆਂ ਪਾ ਕੇ ਆਪਣਾ ਕੰਮ ਸ਼ੁਰੂ ਕਰਦੇ ਹਨ ਜਿਵੇਂ ਕਿ ਉਹ ਸਾਈਕਲਾਂ ਦੇ ਪੁਰਜੇ ਬਣਦੇ ਹਨ ਗੱਡੀਆਂ ਦੇ ਪੁਰਜੇ ਬਣਦੇ ਹਨ ਅਤੇ ਹਾਂਹਾਂ ਬੱਸਾਂ ਦੇ ਟੈਰ ਵਗੈਰਾ ਹਰ ਤਰ੍ਹਾਂ ਦੇ ਛੋਟੇ ਛੋਟੇ ਜੋ ਪੁਰਜੇ ਹਨ ਉਹਨਾਂ ਦੇ ਪੁਰਜੇ ਬਣਦੇ ਹਨ ਜਿਵੇਂ ਕਿ ਇਹ ਫੈਕਟਰੀਆਂ ਵਿੱਚੋਂ ਪੈਕਿੰਗ ਹੋ ਕੇ ਲੁਧਿਆਣੇ ਵਿੱਚ ਇਹ ਬਹੁਤ ਵੱਡੀਆਂ ਫੈਕ ਫੈਕਟਰੀਆਂ ਹੁੰਦੀਆਂ ਜਿੱਥੇ ਪੈਕਿੰਗ ਹੋ ਕੇ ਇਹ ਸਮਾਨ ਬਾਹਰਲੇ ਦੇਸ਼ਾਂ ਵਿੱਚ ਜਾਂਦਾ ਹੈ ਇਹ ਲੋਕ ਆਪਣਾ ਫੈਕਟਰੀਆਂ ਵਿੱਚ ਸਮਾਨ ਪੈਕਿੰਗ ਕਰਨ ਲਈ ਬਹੁਤ ਵੱਡੀਆਂ ਵੱਡੀਆਂ ਫੈਕਟਰੀਆਂ ਖੋਲ੍ਹਦੇ ਹਨ ਅਤੇ ਇਹਨਾਂ ਲਈ ਪੈਕਿੰਗ ਕਰਨ ਲਈ ਬਹੁਤ ਲੋਕ ਆਪਣਾ ਟਾਈਮ ਕੱਢ ਕੇ ਕਰਦੇ ਹਨ ਫੈਕਟਰੀਆਂ ਵੱਡੀਆਂ ਵੱਡੀਆਂ ਫੈਕਟਰੀਆਂ ਪਾਈਆਂ ਹਨ ਲੋਕਾਂ ਨੇ ਆਪਣਾ ਆਪਣਾ ਕੰਮ ਕਾਰੋਬਾਰ ਆਪਣਾ ਆਪਣਾ ਹੱਥ ਕਰਦੇ ਹਨ ਅਤੇ ਇਸਨੂੰ ਬਹੁਤ ਸਹੀ ਢੰਗ ਨਾਲ ਚਲਾ ਰਹੇ ਹਨ ਅਤੇ ਕੈਰੀਅਰ ਆਰਥਿਕ ਯੋਗ ਲਈ ਜੀਵਨ ਬਹੁਤ ਵਧੀਆ ਕੱਟ ਰਹੇ ਹਨ ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈ